ਸਾਡੇ ਭਾਰਤ ਦੇ ਵਿੱਚ ਜ਼ਿਆਦਾਤਰ ਪ੍ਰਸਿੱਧ ਯੋਗਾ ਗੁਰੂ ਰਾਮਦੇਵ ਜੀ ਹਨ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਯੋਗਾ ਸਿਖਾਉਂਦੇ ਹਨ ਅਤੇ ਉਹਨਾਂ ਦਾ ਸਰੀਰ ਤੰਦਰੁਸਤ ਰੱਖਦੇ ਹਨ ਜਿਹਨਾਂ ਵਿੱਚੋਂ ਕਈ ਪ੍ਰਕਾਰ ਦੇ ਈ ਯੋਗਾ ਵਿਧੀਆਂ ਜਿਵੇਂ ਕਿ ਅਲੋਮ ਵਿਲੋਮ ਸ਼ਵ ਆਸਣ ਹੋਰ ਵੀ ਕਈ ਪ੍ਰਕਾਰ ਦੀਆਂ ਹਨ ਜਿਸ ਨਾਲ ਮਤਲਬ ਸਾਹ ਦੀ ਕੋਈ ਦਿੱਕਤ ਨਹੀਂ ਆਉਂਦੀ ਅਤੇ ਆਪਣੇ ਸਰੀਰ ਵਿੱਚ ਫੁਰਤੀ ਅਤੇ ਤੰਦਰੁਸਤੀ ਰਹਿੰਦੀ ਹੈ ਆਪਣੇ ਜਿਹੜੇ ਅੰਗ ਆ ਉਹ ਹਰ ਵੇਲੇ ਮਤਲਬ ਚੁਸਤ ਰਹਿੰਦੇ ਹਨ ਯੋਗਾ ਕਰਨ ਦੇ ਨਾਲ ਉਹਨਾਂ ਦੇ ਨਾਲ ਬਹੁਤ ਹੀ ਦੁਨੀਆ ਜੁੜੀ ਹੈ ਅਤੇ ਉਹਨਾਂ ਦਾ ਜੋ ਲਾਈਵ ਟੈਲੀਕਾਸਟ ਜਿਹੜਾ ਉਹ ਕਈ ਚੈਨਲਾਂ ਦੁਆਰਾ ਵੀ ਦਿਖਾਇਆ ਜਾ ਸਕਦਾ ਹੈ ਜਾਂ ਤਾਂ ਜੋ ਕਈ ਲੋਕ ਉਹਨਾਂ ਨੂੰ ਅਪ ਘਰੇ ਹੀ ਮਤਲਬ ਦੇਖ ਕੇ ਉਹਨਾਂ ਦੀ ਨਕਲ ਕਰ ਸਕਣ ਜਾਂ ਯੋਗਾ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਣ ਕਈ ਤਰ੍ਹਾਂ ਦੇ ਉਹਨਾਂ ਦੇ ਪ੍ਰੋਡਕਟ ਵੀ ਮਤਲਬ ਬਾਜ਼ਾਰ ਵਿੱਚ ਆਉਂਦੇ ਆ ਜਿਵੇਂ ਕਿ ਪੇਸਟ ਵਗੈਰਾ ਸਾਬਣ ਵਗੈਰਾ ਜੋ ਵੀ ਜੋ ਚੀਜ਼ਾਂ ਉਹ ਕਹਿੰਦੇ ਆ ਕਿ ਤੁਸੀਂ ਕੁਦਰਤੀ ਤੌਰ 'ਤੇ ਜੋ ਮਤਲਬ ਜੜੀ ਬੂਟੀਆਂ ਦੇ ਰਾਹੀਂ ਤਿਆਰ ਕੀਤੀਆਂ ਗਈਆਂ ਉਹਨਾਂ ਨੂੰ ਤੁਸੀਂ ਵਰਤੋ ਅਤੇ ਉਹ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਅਤੇ ਕਾਫੀ ਪ੍ਰਸਿੱਧ ਆ ਆਪਣੇ ਭਾਰਤ ਵਿੱਚ